ਮੈਂ ਸਕੂਲ ਸਮੇਂ ਵਿੱਚ ਇੱਕ ਡਰਾਇੰਗ ਬਣਾਈ ਸੀ ਜੋ ਕਿ ਵੂਮੈਨ ਡੇ ਨਾਲ ਸੰਬੰਧਿਤ ਸੀ ਉਸ ਦੇ ਵਿੱਚ ਔਰਤਾਂ ਦੇ ਬਾਰੇ ਉਹਨਾਂ ਨਾਲ ਹੋ ਰਹੇ ਅੱਤਿਆਚਾਰ ਉਹਨਾਂ ਵੱਲੋਂ ਸਹੀਆਂ ਜਾ ਰਹੀਆਂ ਪੀੜਾਵਾਂ ਦੇ ਬਾਰੇ ਪ੍ਰਦਰਸ਼ਿਤ ਕੀਤਾ ਸੀ ਇਸ ਸੰਬੰਧ ਵਿੱਚ ਮੈਨੂੰ ਪੁਰਸਕਾਰ ਵੀ ਮਿਲਿਆ ਸੀ ਮੇਰੇ ਰਿਸ਼ਤੇਦਾਰ ਸਕੂਲ ਦੇ ਟੀਚਰ ਸਭ ਨੇ ਉਹ ਡਰਾਇੰਗ ਬਹੁਤ ਪਸੰਦ ਕੀਤੀ ਸੀ ਮੈਂ ਹੋਰ ਵੀ ਬਹੁਤ ਸਾਰੀਆਂ ਡਰਾਇੰਗਸ ਬਣਾਉਂਦੀ ਰਹਿੰਦੀ ਹਾਂ ਅਤੇ ਇਸ ਦੇ ਬਾਰੇ ਆਪਣੇ ਨਾਲ ਵਾਲੇ ਸਾਥੀਆਂ ਤੋਂ ਉਹਨਾਂ ਦੇ ਸੁਝਾਅ ਪ੍ਰਾਪਤ ਕਰਦੀ ਰਹਿੰਦੀ ਹਾਂ ਉਹ ਮੈਨੂੰ ਆਪਣੀਆਂ ਕਮੀਆਂ ਬਾਰੇ ਦੱਸਦੇ ਹਨ ਅਤੇ ਮੈਂ ਉਸ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜਿੱਥੋਂ ਤੱਕ ਸੰਭਵ ਹੋ ਸਕਦਾ ਹੈ ਮੈਂ ਬਹੁਤ ਸੁਧਾਰ ਕਰਨ ਦੀ ਯਤਨ ਕਰਦੀ ਹਾਂ